ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਸਿੰਪਲ ਚੱਪਲ ਦੇ ਸਿੰਪਲ ਜਿਹੜੀ ਪੰਜਾਬੀ ਜੁੱਤੀ ਲੈਣੀ ਜੇ ਤੁਸੀਂ ਆਫਿਸ ਵਗੈਰਾ ਪਾਉਣ ਦੀਆਂ ਜਾਂ ਸਕੂਲ ਕਾਲਜ 'ਚ ਪਾਉਣੀ ਆ ਸਿੰਪਲ ਚੱਪਲ ਸਿੰਪਲ ਪੰਜਾਬੀ ਜੁੱਤੀ ਉਹਨਾਂ ਦੇ ਘੱਟ ਰੇਟ ਹੈ ਜਿਵੇਂ ਤੁਸੀਂ ਪਾਰਟੀ ਵੇਅਰ ਲੈਣੀ ਆ ਜਿਵੇਂ ਉਹ ਥੋੜ੍ਹੀ ਜਿਹੀ ਕੁ ਹੈਵੀ ਕਢਾਈ ਵਾਲੇ ਹੁੰਦੇ ਆ ਜਾਂ ਸ਼ੀਸ਼ੇ ਲੱਗੇ ਹੁੰਦੇ ਆ ਉਹ ਤੁਹਾਨੂੰ ਪੰਜ ਸੌ ਤੋਂ ਲੈ ਕੇ ਪੱਚੀ ਸੌ ਤੱਕ ਦੀ ਮਿਲ ਜੂਗੀ ਔਰ ਬਹੁਤ ਵਧੀਆ ਵਧੀਆ ਜੁੱਤੀਆਂ ਪਈਆਂ ਹੋਈਆਂ ਤੁਸੀਂ ਆਓ ਕਦੇ ਇੱਥੇ ਵੀਜ਼ਿਟ ਕਰੋ ਜੈਂਟਸ ਦੇ ਹਾਂਜੀ ਜੈਂਟਸ ਦੇ ਵੀ ਬਹੁਤ ਵਧੀਆ ਪਏ ਹੋਏ ਹੈ ਜੈਂਟਸ ਦੇ ਬੂਟ ਵੀ ਹੈ ਸਿੰਪਲ ਚੱਪਲ ਵੀ ਹੈ ਔਰ ਪੰਜਾਬੀ ਜੁੱਤੀ ਵੀ ਪਈ ਹੋਈ ਹੈ ਕੁੜਤੇ ਪਜਾਮੇ ਨਾਲ ਪਾਉਣੇ ਨਾਲ ਜੇ ਕੁੜਤੇ ਪਜਾਮੇ ਨਾਲ ਪਾਉਣੀ ਹੈ ਤਾਂ ਹੋਵੇ ਹਾਂਜੀ ਡਿਜ਼ਾਈਨ ਬਹੁਤ ਵਧੀਆ ਵਧੀਆ ਤੁਹਾ ਦੇ ਉਰੇ ਆ ਕੇ ਹੀ ਦੇਖਣੇ ਪੈਣੇ ਆ ਹਾਂ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਪਏ ਹੈ ਬੈਲੀ ਵਗੈਰਾ ਲੈ ਸਕਦੇ ਹੋ ਤੁਸੀਂ ਔਰ ਸਿੰਪਲ ਚੱਪਲ ਵੀ ਲੈ ਸਕਦੇ ਹੈ ਜਿਵੇਂ ਸਮਰ ਦੇ ਬਹੁਤ ਅੱਛੇ ਅੱਛੇ ਆਏ ਹੋਏ ਆ ਹੀਲ ਵਾਲੇ ਵੀ ਬਿਨਾਂ ਹੀਲ ਤੋਂ ਵੀ ਰੇਟ ਤੁਹਾਡੇ ਚੋਇਸ ਮੁਤਾਬਿਕ ਹੈ ਜਿਸ ਤਰ੍ਹਾਂ ਦੇ ਤੁਸੀਂ ਪਸੰਦ ਕਰੋਂਗੇ ਉਹੋ ਜਿਹਾ ਹੀ ਮਿਲੇਗਾ ਹਾਂਜੀ ਹਾਂਜੀ ਪਾਰਟੀ ਵੇਅਰ ਥੋੜ੍ਹੀ ਥੋੜ੍ਹੀ ਮਹਿੰਗੀ ਪੈ ਜਾਂਦੀ ਹੈ ਜੇ ਫਿਰ ਸਿੰਪਲ ਚੱਪਲ ਲੈਣੀ ਹੈ ਉਹ ਠੀਕ ਰੇਟ 'ਤੇ ਪੈ ਜਾਏਗੀ ਬਾਕੀ ਡਿਜ਼ਾਈਨ ਬਹੁਤ ਪਏ ਹੋਏ ਆ ਤੁਸੀਂ ਆ ਕੇ ਦੇਖ ਸਕਦੇ ਹੋ ਹਾਂਜੀ ਬੱਚਿਆਂ ਦੇ ਵੀ ਸਾਰੇ ਤਰ੍ਹਾਂ ਦੇ ਚੱਪਲ ਪਏ ਹੋਏ ਆ ਸਕੂਲ ਸ਼ੂਜ ਪਏ ਆ ਉਹਨਾਂ ਦੇ ਸਪੋਰਟਸ ਸ਼ੂਜ਼ ਪਏ ਹੈ ਹਾਂਜੀ ਸਕੂਲ ਦੇ ਹਰ ਕਲਰ ਦੇ ਵਾਈਟ ਔਰ ਬਲੈਕ ਤਰ੍ਹਾਂ ਬਲੈਕ ਵੀ ਪਏ ਹੋਏ ਹੈ ਸਾਰੇ ਤਰ੍ਹਾਂ ਦੇ ਪਏ ਹੈ ਹਰ ਨੰਬਰ 'ਚ ਸਾਡੇ ਕੋਲ ਅਵੇਲੇਬਲ ਹੈ ਛੋਟਾ ਬੜਾ ਠੀਕ ਹੈ ਜੀ ਥੈਂਕ ਯੂ ਜੀ